ਪੰਜਾਬ ਵਿੱਚ ਮਨੋਰੰਜਨ ਦੇ ਬਹੁਤ ਸਾਧਨ ਹਨ ਮੈਂ ਇਸ ਬਠਿੰਡਾ ਸ਼ਹਿਰ ਵਿੱਚ ਇੱਕ ਕਿਲ੍ਹਾ ਹੈ ਬਹੁਤ ਪੁਰਾਣਾ ਕਿਲ੍ਹਾ ਕਿਲ੍ਹਾ ਹੈ ਇਸ ਨਾਲ ਹੋਰ ਵੀ ਬਹੁਤ ਰੇਲਵੇ ਟੇਸ਼ਨ ਹੈ ਉਸਦੇ ਵੀ ਬਹੁਤ ਚੀਜ਼ਾਂ ਵੇਖਣ ਨੂੰ ਮਿਲਦੀਆਂ ਹਨ ਅਤੇ ਅਤੇ ਫਿਰ ਪਿੰਡਾਂ ਵਿੱਚ ਲੋਕ ਪਰਿਵਾਰਾਂ ਸਮੇਤ ਖੇਡਾਂ ਖੇਡਦੇ ਹਨ ਔਰ ਸ਼ਾਪਿੰਗ ਮੋਲਾਂ ਵਿੱਚ ਵੀ ਜਾਂਦੇ ਹਨ ਅਤੇ ਇਸ ਦੇ ਨਾਲ ਹੀ ਪਰਿਵਾਰ ਦੀਆਂ ਲੋੜ ਪੂਰੀ ਨਾ ਕਰਨ ਲਈ ਸ਼ਾਪਿੰਗ ਮੋਲ ਰੈਸਟੋਰੈਂਟ ਕਲੱਬਾਂ ਵਿੱਚ ਪਰਿਵਾਰ ਨੂੰ ਲੈ ਕੇ ਜਾਂਦੇ ਜਿਸ ਨਾਲ ਬੱਚੇ ਬੱਚਿਆਂ ਨੂੰ ਬਾਹਰਲੀ ਦੁਨੀਆਂ ਬਾਰੇ ਪਤਾ ਲੱਗਦਾ ਹੈ ਅਤੇ ਬੱਚ ਫਿਰ ਪੰਜਾਬ ਵਿੱਚ ਲੋਕ ਆਪਣੇ ਪਰ ਸੱਥਾਂ ਪਿੰਡ ਦੀ ਸੱਥ ਵਿੱਚ ਜਾਂਦੇ ਹਨ ਜਿੱਥੇ ਉੱਥੇ ਤਾਸ਼ ਵੀ ਖੇਡੀ ਜਾਂਦੀ ਹੈ ਔਰ ਤਾਸ਼ ਖੇਡਦੇ ਹਨ ਅਤੇ ਆਪਣੇ ਵਿਚਾਰ ਇਕ ਦੂਜੇ ਨੂੰ ਦੱਸਦੇ ਹਨ ਜਿਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਵੀ ਬਹੁਤ ਚੀਜ਼ਾਂ ਸਿੱਖਣ ਨੂੰ ਆਪਣੇ ਆਪਣੀਆਂ ਪੀੜ੍ਹੀ ਤੋਂ ਪਹਿਲਾਂ ਵਾਲੀਆਂ ਪੀੜ੍ਹੀਆਂ ਤੋਂ ਸਿੱਖਣ ਨੂੰ ਤਜਰਬਾ ਮਿਲਦਾ ਹੈ ਅਤੇ ਫਿਰ ਉਹ ਆਪਣੇ ਨਾਲ ਖੇਡਾਂ ਖੇਡਦੇ ਹਨ ਜਿਵੇਂ ਕਬੱਡੀ ਟੂਰਨਾਮੈਂਟ ਵਿੱਚ ਰੇਸ ਰੂਸ ਆਦਿ ਲਗਾਉਂਦੇ ਹਨ ਅਤੇ ਜਿਸ ਨਾਲ ਹੋਰ ਵੀ ਬਹੁਤ ਚੀਜ਼ਾਂ ਜੋ ਪੰਜਾਬ ਵਿੱਚ ਵਾਸ਼ਿਸਤ ਹਨ ਇਸ ਲਈ ਪੰਜਾਬ ਇੱਕ ਹਰਾ ਭਰਾ ਦੇਸ਼ ਹੈ ਜੀ ਧੰਨਵਾਦ